ਮੇਰਾ ਜਿਹੜਾ ਨਿੱਜੀ ਟੀਚਾ ਹੈ ਉਹ ਲੋੜਵੰਦਾਂ ਦੀ ਮਦਦ ਕਰਨਾ ਹੈ ਠੀਕ ਹੈ ਕਿ ਜਦੋਂ ਵੀ ਮੈਨੂੰ ਕਿੱਥੋਂ ਅ ਪ੍ਰੇਰਨਾ ਮਿਲਦੀ ਹੈ ਜਦੋਂ ਮੈਂ ਦੇਖਦੀ ਹਾਂ ਕਿ ਕੋਈ ਲੋੜਵੰਦ ਹੈ ਠੀਕ ਹੈ ਨਾ ਕਿ ਮੈਂ ਉਦਾਹਰਨ ਦਿੰਦੀ ਹਾਂ ਕਿ ਮੇਰੇ ਪਿੰਡ ਵਿੱਚ ਇੱਕ ਇੱਦਾਂ ਦੀ ਫੈਮਿਲੀ ਆ ਜਿਹਦੇ ਵਿੱਚ ਅੱਠ ਲੋਕ ਹੈ ਠੀਕ ਹੈ ਪਰ ਜਿਹੜਾ ਉਹਨਾਂ ਦਾ ਘਰ ਦਾ ਗੁਜ਼ਾਰਾ ਹੈ ਉਹ ਵੀ ਚੰਗੀ ਤਰ੍ਹਾਂ ਨਹੀਂ ਹੁੰਦਾ ਠੀਕ ਹੈ ਉਹ ਚੀਜ਼ ਨੂੰ ਦੇਖ ਕੇ ਫਿਰ ਮੇਰਾ ਕੀ ਹੈ ਕਿ ਦਿਲ ਕਰਦਾ ਹੈ ਕਿ ਹਾਂਜੀ ਮੈਂ ਉਹਨਾਂ ਦੀ ਮਦਦ ਕਰਾਂ ਠੀਕ ਹੈ ਉਹ ਮਦਦ ਕਰਨ ਲਈ ਮੈਨੂੰ ਕੀ ਹੈ ਫਾਈਨਾਸ਼ੀਅਲੀ ਮੈਂ ਆਪਣੇ ਆਪ ਨੂੰ ਹੋਰ ਜ਼ਿਆਦਾ ਸਟਰੋਂਗ ਕਰ ਰਹੀ ਹਾਂ ਮੈਂ ਇੱਦਾਂ ਦਾ ਕਿਤੇ ਨਾ ਕਿਤੇ ਕੁਛ ਕਰ ਰਹੀ ਹਾਂ ਮਿਹਨਤ ਕਰ ਰਹੀ ਹਾਂ ਕਿ ਜਿੱਥੋਂ ਮੈਨੂੰ ਜਿਹੜੀ ਹੈਗੀ ਆ ਪੈਸਾ ਹੈ ਉਹ ਮੇਰਾ ਕੁਛ ਹੋਰ ਮੈਨੂੰ ਜ਼ਿਆਦਾ ਮੈਨੂੰ ਬਣੇ ਤਾਂ ਕਿ ਜਿਹੜੇ ਉਹ ਲੋੜਵੰਦ ਪਰਿਵਾਰ ਆ ਮੈਂ ਉਹਨਾਂ ਦੀ ਮਦਦ ਕਰ ਸਕਾਂ